ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸੋ ਈਵਨਿੰਗ ਟਾਈਮ ਰੱਖਿਆ ਹੋਇਆ ਅਸੀਂ ਛ ਚਾਰ ਤੋਂ ਛੇ

ਜਿੱਦਾਂ ਕਿ ਅਸੀਂ ਕਲਾਸਸ ਦਿੰਦੇ ਹਾਂ ਕਿ ਹਾਰਮੋਨੀਅਮ ਹੋ ਗਿਆ ਤਬਲਾ ਹੋ ਗਿਆ ਕੀਬੋਰਡ ਹੋ ਗਿਆ ਗਿਟਾਰ ਹੋ ਗਈ ਸਾਡੇ ਕੋਲ ਚਾਰ ਸਾਜ ਨੇ ਜਿਹੜੇ ਕਿ ਮਤਲਬ ਕਿ ਅਸੀਂ ਵਜਾਉਣਾ ਸਿਖਾਉਂਦੇ ਹਾਂ ਅਤੇ ਇਹਦੇ ਨਾਲ ਤੁਸੀਂ ਇਕੱਲਾ ਇਹ ਵਜਾ ਵੀ ਨਹੀਂ ਵਜਾ ਹੀ ਨਹੀਂ ਸਕਦੇ ਸਗੋਂ ਇਹ ਤੁਸੀਂ ਖੁਦ ਵੀ ਗਾ ਵੀ ਸਕਦੇ ਹੋ ਜੇਕਰ ਤੁਸੀਂ ਵਜਾਉਣ ਦੇ ਇੱਛੁਕ ਹੋ ਤਾਂ ਤੁਸੀਂ ਇਕੱਲਾ ਵਜਾ ਵਜਾ ਵਜਾਉਣਾ ਵੀ ਸਿੱਖ ਸਕਦੇ ਹੋ ਅਗਰ ਤੁਸੀਂ ਨਾਲ ਨਾਲ ਸਿੰਗਿੰਗ ਵੀ ਕਰਨਾ ਚਾਹੁੰਦੇ ਹੋ ਤਾਂ ਸਿੰਗ ਸਿੰਗਿੰਗ ਵੀ ਕਰ ਸਕਦੇ ਹੋ ਹਾਂ ਸਵੇਰ ਦਾ ਨਹੀਂ ਹੋ ਸਕਦਾ ਉਦੋਂ ਚਾਰ ਤੋਂ ਪਹਿਲਾਂ ਹੋ ਸਕਦਾ ਜਿੱਦਾਂ ਕੇ ਤਿੰਨ ਤੋਂ ਚਾ ਦੋ ਤੋਂ ਚਾਰ ਹੋ ਸਕਦਾ ਜਾਂ ਤਿੰਨ ਤੋਂ ਚਾਰ ਹੋ ਸਕਦਾ ਜੀ ਅਗਰ ਜੇ ਤੁਸੀਂ ਸਵੇਰ ਦੇ ਟਾਈਮ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਥੋੜ੍ਹਾ ਜਿਹਾ ਜਲਦੀ ਜਿੱਦਾਂ ਕਿ ਛੇ ਤੋਂ ਅੱਠ ਹੋ ਗਿਆ ਹੈ ਨਾ ਵੀ ਅੱਠ ਵਜੇ ਤੱਕ ਤੋਂ ਬਾਅਦ ਨਹੀਂ ਅਸੀਂ ਕਰਵਾਉਂਦੇ ਗੇ ਕਿ ਛੇ ਤੋਂ ਅੱਠ ਦੇ ਵਿੱਚ ਵਿੱਚ ਕਰ ਕਰ ਸਕਦੇ ਆ ਤੁਸੀਂ ਹਾਂਜੀ